ਗਰਮੀ ਅਤੇ ਸਰਦੀ ਇਹ ਦੋ ਮੌਸਮ ਹੁੰਦੇ ਆ ਜਿਹੜੇ ਜਿਵੇਂ ਸਾਡੀ ਬਾਡੀ 'ਤੇ ਅਸਰ ਇਨਸਾਨ ਦੀ ਬਾਡੀ 'ਤੇ ਅਸਰ ਕਰਦੇ ਆ ਇੱਦਾਂ ਹੀ ਜਾਨਵਰਾਂ ਦੀ ਬੋਡੀ 'ਤੇ ਵੀ ਇਹਨਾਂ ਦਾ ਪ੍ਰਭਾਵ ਮੌਸਮ ਦਾ ਸੋ ਇਹ ਆ ਵੀ ਅਲੱਗ ਅਲੱਗ ਜਾਨਵਰਾਂ ਦੇ ਬਾਡੀ ਆ ਅਲੱਗ ਅਲੱਗ ਤਰੀਕੇ ਦਾ ਰੱਖ ਰਖਾਓ ਹੋਣਾ ਚਾਹੀਦਾ ਸਰਦੀ 'ਚ ਜਿਵੇਂ ਬਹੁਤ ਜ਼ਿਆਦਾ ਸਰਦੀ ਹੋਵੇ ਜਿਵੇਂ ਕੋਈ ਡੰਗਰ ਜਿਵੇਂ ਮੱਝ ਹੈ ਗਾਂ ਵਾ ਕੁਛ ਵੀ ਆ ਉਹਨਾਂ ਦੇ ਸਰੀਰ ਨੂੰ ਹੀਟ ਲਈ ਇੱਕ ਤਾਂ ਉਹਨਾਂ ਦਾ ਆਲਾ ਦੁਆਲਾ ਬਹੁਤ ਜ਼ਿਆਦਾ ਸਾਫ਼ ਸੁਥਰਾ ਰੱਖਣਾ ਚਾਹੀਦਾ ਜਿਵੇਂ ਕੋਈ ਪਸ਼ੂ ਨੇ ਗਾਂ ਵਾ ਮੱਝ ਆ ਉਹਨਾਂ ਦਾ ਜਿਹੜੀ ਹਵੇਲੀ ਆ ਉਹਨੂੰ ਬਹੁਤ ਸਾਫ਼ ਸੁਥਰਾ ਰੱਖੋ ਉਹਨਾਂ ਦਾ ਖਾਣ ਜ ਜਿਹੜਾ ਹੈਗਾ ਉਹਨਾਂ ਦਾ ਪੱਠੇ ਵਗੈਰਾ ਹੈਗੇ ਆ ਉਹਨਾਂ ਨੂੰ ਇੱਕ ਵਧੀਆ ਤਰੀਕੇ ਦੀ ਚੰਗੀ ਖੁਰਾਕ ਦੇਣੀ ਚਾਹੀਦੀ ਆ ਜਿਹਦੇ ਨਾਲ ਉਹਨਾਂ ਦਾ ਸਰੀਰ ਠੀਕ ਰਹੇ ਕਿਉਂਕਿ ਜਾਨਵਰ ਸਾਨੂੰ ਦੁੱਧ ਵਗੈਰਾ ਦਿੰਦੇ ਆ ਜਿਹਦੇ ਨਾਲ ਸਾਡੀ ਬੋਡੀ ਵੀ ਜੇ ਅਸੀਂ ਉਹਨਾਂ ਨੂੰ ਅੱਛਾ ਖਾਣ ਨੂੰ ਦੇਵਾਂਗੇ ਤਾਂ ਸਾਨੂੰ ਅੱਛਾ ਦੇਣਗੇ ਸਰਦੀਆਂ 'ਚ ਇਹਨਾਂ ਦਾ ਜਿਹੜਾ ਜਿੱਥੇ ਬੰਨੇ ਜਾਂਦੇ ਆ ਉੱਥੇ ਇਹਨਾਂ ਦੀ ਕੋਈ ਕੋਈ ਗਰਮ ਹੀਟ ਜਾਂ ਹੀਟਰ ਵਗੈਰਾ ਕੁਛ ਲਗਾ ਦੇਣਾ ਚਾਹੀਦਾ ਅਤੇ ਇਹਨਾਂ ਦੇ ਸਰੀਰ ਦੇ ਉੱਤੇ ਕੋਈ ਨਾ ਕੋਈ ਜਿਵੇਂ ਬੋਰੀ ਤਰਪਾਲ ਵਗੈਰਾ ਪਾਉਣੀ ਚਾਹੀਦੀ ਆ ਅਤੇ ਗਰਮੀਆਂ 'ਚ ਇਹਨਾਂ ਦੇ ਪੱਖਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਕੂਲਰ ਦਾ ਇੰਤਜ਼ਾਮ ਹੋਣਾ ਚਾਹੀਦਾ ਮੱਖੀ ਮੱਛਰ ਤੋਂ ਇਹਨਾਂ ਦਾ ਬਚਾਅ ਰੱਖਣਾ ਚਾਹੀਦਾ ਕੋਈ ਉੱਥੇ ਧੂੰਆ ਵਗੈਰਾ ਕਰਕੇ ਨਾ ਤਾਂ ਕਿ ਮੱਛਰ ਨਾ ਆ ਸਕੇ ਇਸ ਕਰਕੇ ਗਰਮੀ 'ਚ ਇਹਨਾਂ ਨੂੰ ਬੋਡੀ ਨੂੰ ਹੀਟ ਲਈ ਕੋਈ ਨਾ ਕੋਈ ਹੀਟਰ ਵਗੈਰਾ ਅਤੇ ਸਰ ਸ ਸਰਦੀ ਲਈ ਹੀਟਰ ਵਗੈਰਾ ਅਤੇ ਗਰਮੀ ਲਈ ਇਹਨਾਂ ਦੇ ਕੂਲਰ ਪੱਖਾ ਵਗੈਰਾ ਇਹਨਾਂ ਨੂੰ ਜਿਵੇਂ ਇਨਸਾਨ ਦੀ ਬਾਡੀ ਨੂੰ ਜ਼ਰੂਰਤ ਹੁੰਦੀ ਆ ਇੱਦਾਂ ਜਾਨਵਰਾਂ ਦੇ ਸਰੀਰਿਕ ਲਈ ਵੀ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਆ ਸੋ ਇਹ ਆ ਵੀ ਗਰਮੀ ਦੇ ਵਿੱਚ ਪੱਖੇ ਕੂਲਰ ਵਗੈਰਾ ਇਹਨਾਂ ਦੇ ਕੋਲ ਰੱਖਣੇ ਚਾਹੀਦੇ ਆ ਅਤੇ ਆਲਾ ਦੁਆਲਾ ਇਹਨਾਂ ਦਾ ਸਾਫ਼ ਸੁਥਰਾ ਰੱਖਣਾ ਚਾਹੀਦਾ